ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਸੀਂ ਗੁਪਤਾ ਮਿਊਜੀਕਲ ਇੰਸਟਰੂਮੈਂਟ ਵਾਲੇ ਬੋਲਣ ਦਿਓ ਨਾ ਭਲਾ ਹੋਰ ਸੁਣਾਓ ਭਾਅ ਜੀ ਕੀ ਹਾਲ ਜੇ ਬਸ ਵਧੀਆ ਭਾਅ ਜੀ ਮੈਂ ਤੁਹਾਡੇ ਕੋਲ ਨਾ ਥੋੜ੍ਹੇ ਗਿਟਾਰ ਇੰਸਟਰੂਮੈਂਟ ਬਾਰੇ ਪਤਾ ਕਰਨਾ ਸੀਗਾ ਐਕਚੁਲੀ ਮੈਂ ਨਾ ਯਾਰ ਗਿਟਾਰ ਪਰਚੇਸ ਕਰਨ ਬਾਰੇ ਸੋਚਿਆ ਕਰਦਾ ਸੀਗਾ ਪੀ ਐਸ ਸਿਗਨੇਚਰ ਦਾ ਹੀ ਚਾਹੀਦਾ ਪਰ ਮੈਨੂੰ ਨਹੀਂ ਨਹੀਂ ਪੀ ਐਸ ਸਿਗਨੇਚਰ ਦਾ ਭਾਅ ਜੀ ਹਾਂਜੀ ਅਤੇ ਭਾਅ ਜੀ ਕੀ ਉਹਦਾ ਪ੍ਰਾਈਜ਼ ਵਗੈਰਾ ਨਹੀਂ ਨਹੀਂ ਠੀਕ ਠੀਕ ਲਾਓ ਭਾਅ ਜੀ ਨਹੀਂ ਭਾਅ ਜੀ ਅੋਨਲਾਈਨ ਮੈਂ ਚੈੱਕ ਕੀਤਾ ਸੀ ਉੱਥੇ ਅੱਠ ਹਜ਼ਾਰ ਦਾ ਦੱਸੀ ਕਰਦੇ ਹੀਗਾ ਤੁਸੀਂ ਮਹਿੰਗਾ ਲਾਉਂਦੇ ਪਏ ਹੈ ਨਹੀਂ ਨਹੀਂ ਭਾਅ ਜੀ ਇਹ ਵੀ ਵੱਧ ਹੈ ਵਰੰਟੀ ਤਾਂ ਅੋਨਲਾਈਨ ਵੀ ਮਿਲਣੀ ਆ ਹਾਂਜੀ ਉਹ ਤਾਂ ਹੈ ਫਿਰ ਵੀ ਤੁਸੀਂ ਥੋੜ੍ਹਾ ਹੋਰ ਲੈਸ ਕਰੋ ਮੈਂ ਹੋਰ ਵੀ ਮੇਰੇ ਫਰੈਂਡਸ ਨੇ ਲੈਣਾ ਗਿਟਾਰ ਵਗੈਰਾ ਉਹ ਵੀ ਸਿੱਖੇ ਕਰਦੇ ਆ ਅਤੇ ਫਿਰ ਮੈਂ ਤੁਹਾਡਾ ਹੀ ਲਿੰਕ ਕਰਾ ਦਾਂਗਾ ਉਹਦੇ ਨਾਲ ਹੀ ਤੁਹਾਡੇ ਕੋਲ ਲੈ ਦਾਂਗਾ ਹਾਂਜੀ ਹਾਂਜੀ ਉਹ ਤਾਂ ਹੈ ਚਲੋ ਠੀਕ ਹੈ ਭਾਅ ਜੀ ਫਿਰ ਮੈਂ ਤੁਹਾਨੂੰ ਕਰਾਂਗਾ ਫੋਨ ਓਕੇ ਬਾਏ ਭਾਅ ਜੀ ਥੈਂਕ ਯੂ